ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਜੈਸਲੀਨ ਦੇ ਪੇਰੇਂਟਸ ਬੋਲ ਰਹੇ ਹੋ ਜੀ ਹਾਂਜੀ ਹਾਂਜੀ ਹਾਂਜੀ ਜੈਸਲੀਨ ਦੀ ਰਿਪੋਰਟ ਬਹੁਤ ਅੱਛੀ ਹੈ ਜੀ ਏਗਜਾਮਜ਼ ਜਿਹੜੇ ਹੋਏ ਹੈ ਬਹੁਤ ਅੱਛੀ ਹੈ ਜੀ ਇਹ ਕਲਾਸ 'ਚ ਐਕਟਿਵ ਰਹਿੰਦੀ ਹੈ ਅ ਕੋਨਸਨਟ੍ਰੇਟ ਰਹਿੰਦੀ ਹੈ ਕਲਾਸ ਵਿੱਚ ਬਹੁਤ ਅੱਛੇ ਮਾਰਕਸ ਆਏ ਹੈ ਤੁਸੀਂ ਆਏ ਨੀ ਜੀ ਪੀ ਟੀ ਐਮ 'ਤੇ ਠੀਕ ਹੈ ਸਰ ਪੜ੍ਹਾਈ ਵਿੱਚ ਬਹੁਤ ਅੱਛੀ ਹੈ ਐਵਰੇਜ ਸਟੂਡੈਂਟ ਹੈ ਕਿਉਂਕਿ ਫਸਟ ਐਗਜਾਮ ਸੀਗੇ ਇੰਨ੍ਹਾਂ ਦੀ ਬੱਚਿਆਂ ਦਾ ਫਸਟ ਐਕਸਪੀਰੀਐਂਸ ਸੀਗਾ ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹਾ ਜਿਹਾ ਤਾਂ ਪਹਿਲਾਂ ਬੱਚੇ ਕਰਦੇ ਹੀ ਹੈ ਹਾਂਜੀ ਬਟ ਠੀਕ ਰਿਹਾ ਕਲਾਸ ਵਿੱਚ ਵੀ ਵਧੀਆ ਕਰਦੀ ਹੈ ਇਗਜਾਮਜ਼ਸ ਵਿੱਚ ਵੀ ਵਧੀਆ ਕਰਿਆ ਤੁਸੀਂ ਅਗਰ ਨਹੀਂ ਆ ਸਕੇ ਤਾਂ ਫਿਰ ਕਿਸੇ ਦਿਨ ਆ ਕੇ ਕਲਾ ਮੇਰੇ ਨਾਲ਼ ਤੁਸੀਂ ਮੈਨੂੰ ਮਿਲ ਲਓ ਅੱਛਾ ਜੀ ਸਰ ਕੋਈ ਗੱਲ ਨੀ ਤੁਸੀਂ ਆ ਕੇ ਜਦੋਂ ਮਰਜ਼ੀ ਦੇਖ ਜਾਓ ਰਿਪੋਰਟ ਕਾਰਡ ਨਹੀਂ ਨਹੀਂ ਬ ਕੋਈ ਲੋੜ ਨਹੀਂ ਟਿਊਸ਼ਨ ਦੀ ਅਤੇ ਬੱਚਾ ਠੀਕ ਹੈ ਪੜ੍ਹਨ 'ਚ ਅੱਛਾ ਹੈ ਬਾਕੀ ਤੁਸੀਂ ਥੋੜੇ ਬਹੁਤੇ ਘਰ ਐਫਰਟਸ ਕਰਿਓ ਬੱਚਾ ਠੀਕ ਹੈ ਜੀ ਪੜ੍ਹਨ ਨੂੰ ਹਾਂਜੀ ਹਾਂਜੀ ਔਲ ਰਾਊਂਡਰ ਹੈ ਸਰ ਕਲਾਸ ਵਿੱਚ ਐਕਟਿਵ ਰਹਿੰਦੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਕੋਈ ਦਿੱਕਤ ਨਹੀਂ ਜੀ ਹੈ ਸਰ ਨਹੀਂ ਨਹੀਂ ਸਰ ਹਜੇ ਤਾਂ ਬੱਚਿਆਂ ਦਾ ਫਸਟ ਐਕਸਪੀਰੀਐਂਸ ਸੀਗਾ ਤੁਹਾਨੂੰ ਪਤਾ ਬੱਚੇ ਛੋਟੇ ਹੈ ਠੀਕ ਹੈ ਸਰ ਕਲਾਸ ਵਿੱਚ ਵੀ ਠੀਕ ਹੈ ਵੈਸੇ ਵੀ ਠੀਕ ਹੈ ਸਟੱਡੀ ਦੇ ਰਿਗਾਰਡਿੰਗ ਇੱਦਾਂ ਦੀ ਕੋਈ ਦਿੱਕਤ ਨਹੀਂ ਜੀ ਠੀਕ ਹੈ ਸਰ ਓਕੇ ਥੈਂਕ ਯੂ ਸ